ਨਮਸਕਾਰ ਭੈਣ ਜੀ ਕੀ ਹਾਲ ਹੈ ਤੁਹਾਡੇ ਇਧਰ ਸਭ ਵਧੀਆ ਹੈ ਮੈਂ ਇੱਕ ਚੀਜ਼ ਦੱਸਣਾ ਚਾਹੁੰਦੀ ਸੀ ਤੁਹਾਨੂੰ ਕਿ ਮੈਂ ਆਪਣੇ ਪੁਨਰਵਾਸ ਬਾਰੇ ਸੋਚ ਰਹੀ ਹਾਂ ਮੇਰਾ ਇੱਥੇ ਕੰਮ ਠੀਕ ਨਹੀਂ ਚੱਲ ਰਿਹਾ ਮੈਨੂੰ ਕਿਸੇ ਦੂਜੀ ਥਾਂ ਦੂਜੇ ਪਿੰਡ ਵਿੱਚ ਨੌਕਰੀ ਮਿਲ ਰਹੀ ਹੈ ਮੈਂ ਦੂਜੀ ਥਾਂ ਜਦੋਂ ਜਾਣਾ ਹੈ ਮੈਨੂੰ ਇੱਕ ਉਸ ਘਰ ਦੇ ਵਿੱਚ ਮੈਂ ਆਪਣਾ ਇੱਕ ਨਵਾਂ ਕਿਰਾਏ 'ਤੇ ਘਰ ਵੀ ਲੈਣਾ ਹੈ ਮੈਨੂੰ ਉਹਦੇ ਵਾਸਤੇ ਆਪਣੇ ਪਾਸਪੋਰਟ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ ਜਿਹਦੇ ਵਿੱਚ ਮੇਰਾ ਪਤਾ ਨਵਾਂ ਹੋਵੇਗਾ ਉਹ ਪਤਾ ਨਵਾਂ ਕਰਨ ਦਾ ਮੈਨੂੰ ਪ੍ਰਕਿਰਿਆ ਦਾ ਕੁਛ ਥੋੜ੍ਹਾ ਤੁਹਾਡੇ ਕੋਲੋਂ ਉਹ ਚਾਹੀਦਾ ਕਿ ਮੈਨੂੰ ਕਿੱਦਾਂ ਕਰਨਾ ਹੈ ਇਹਨੂੰ ਮੈਨੂੰ ਇਹਦੇ ਬਾਰੇ ਥੋੜ੍ਹਾ ਇਸ ਚੀਜ਼ ਉੱਤੇ ਥੋੜ੍ਹਾ ਰੌਸ਼ਨੀ ਪਾਓਗੇ ਕਿ ਇਹਨੂੰ ਕਿੱਦਾਂ ਮੈਂ ਆਪਣੇ ਪਾਸਪੋਰਟ ਨੂੰ ਅਪਡੇਟ ਕਰ ਸਕਦੀ ਹਾਂ ਮੈਨੂੰ ਇਹਨਾਂ ਦਾ ਕਿਹੜੇ ਕਿਹੜੇ ਸਬਮੇ ਪਾਸਪੋਰਟ ਨੂੰ ਅਪਡੇਟ ਕਰਨ ਲਈ ਕਿਹੜੇ ਕਿਹੜੇ ਦਸਤਾਵੇਜਾਂ ਦੀ ਜ਼ਰੂਰਤ ਪਵੇਗੀ ਅਤੇ ਆਪਣੇ ਇੱਕ ਆਧਾਰ ਅਤੇ ਪੈਨ ਕਾਰਡ ਤੋਂ ਇਲਾਵਾ ਮੈਨੂੰ ਹੋਰ ਕੀ ਰੱਖਣਾ ਪਵੇਗਾ ਆਪਣੇ ਕੋਲ ਮੈਂ ਆਪਣੀ ਡਿਗਰੀਆਂ ਤਾਂ ਇਕੱਠੀਆਂ ਕਰ ਲਈਆਂ ਹਨ ਆਪਣੇ ਯੋਗਤਾ ਆਪਣੇ ਕੋਈ ਉਮਰ ਦਾ ਕੋਈ ਜਾਂ ਕੁਛ ਹੋਰ ਚੀਜ਼ ਚਾਹੀਦੀ ਹੋਵੇ ਇਹਨੂੰ ਕਿੰਨਾ ਕੁ ਸਮਾਂ ਲੱਗ ਜਾਂਦਾ ਹੈ ਬਲਕਿ ਕਿੰਨਾ ਕੁ ਸਮਾਂ ਲੱਗ ਜਾਵੇਗਾ ਕਿਉਂਕਿ ਮੈਂ ਉੱਥੇ ਉਸ ਘਰ ਦਾ ਜਦੋਂ ਬਿਆਨਾ ਦੇਣਾ ਹੈ ਮੈਨੂੰ ਆਪਣੇ ਇਸ ਦਸਤਾਵੇਜ਼ ਨੂੰ ਜਮ੍ਹਾਂ ਕਰਵਾਉਣਾ ਬਹੁਤ ਜ਼ਰੂਰੀ ਹੈ ਅਤੇ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਮੈਨੂੰ ਇਹਨੂੰ ਇਹ ਮੇਰਾ ਕੰਮ ਛੇਤੀ ਤੋਂ ਛੇਤੀ ਪਾਸਪੋਰਟ ਦਫ਼ਤਰ 'ਚੋਂ ਜੋ ਕਿ ਅੱਜ ਕੱਲ੍ਹ ਆਨਲਾਈਨ ਵੀ ਹੋ ਗਿਆ ਹੈ ਮੈਨੂੰ ਪਤਾ ਹੈ ਬਹੁਤ ਜਲਦੀ ਹੋ ਜਾਂਦਾ ਹੈ ਫਿਰ ਵੀ ਮੈਨੂੰ ਇੱਕ ਥੋੜ੍ਹਾ ਚੰਗੀ ਤਰ੍ਹਾਂ ਜੇ ਤੁਸੀਂ ਇੱਕ ਇੱਕ ਗੱਲ ਨੂੰ ਸਮਝਾ ਦੇਵੋਗੇ ਤਾਂ ਮੇਰੇ ਲਈ ਬਹੁਤ ਸੌਖਾ ਹੋ ਜਾਵੇਗਾ